ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਸਾਡੇ ਲਾਗੇ ਵੇਰਕੇ ਵਾਲਿਆਂ ਦੀ ਹੈਗੀ ਆ ਜੀ ਹਾਂ ਉੱਥੋਂ ਵਧੀਆ ਮਿਲ ਜਾਂਦੀਆਂ ਨੇ ਬਸ ਦਸ ਮਿੰਟ ਦਾ ਰਸਤਾ ਹੈ ਜੀ ਉੱਥੇ ਭਾਅ ਜੀ ਦੁੱਧ ਦਹੀਂ ਪਨੀਰ ਮੱਖਣ ਸਭ ਕੁਛ ਮਿਲ ਜਾਏਗਾ ਔਰ ਫਰੈੱਸ਼ ਹੁੰਦਾ ਸਾਰਾ ਹਾਂਜੀ ਹਾਂਜੀ ਅਸੀਂ ਉੱਥੋਂ ਹੀ ਡੇਲੀ ਉੱਥੇ ਹੀ ਲੈ ਕੇ ਆਈ ਦਾ ਹਾਂਜੀ ਤੁਹਾਨੂੰ ਕਿਆ ਚਾਹੀਦਾ ਭਾਅ ਜੀ ਅੱਛਾ ਜੀ ਠੀਕ ਹੈ ਟਾਈਮ ਸ ਸਵੇਰੇ ਵੀ ਹੁੰਦੇ ਨੇ ਉਹ ਸ਼ਾਮ ਨੂੰ ਵੀ ਹੁੰਦੇ ਨੇ ਸਵੇਰੇ ਅੱਠ ਵਜੇ ਖੁੱਲ੍ਹ ਜਾਂਦੀ ਉਹਨਾਂ ਦੀ ਅੱਠ ਤੋਂ ਬਾਰ੍ਹਾਂ ਵਜੇ ਤੱਕ ਹੁੰਦੇ ਆ ਸ਼ਾਮ ਨੂੰ ਫਿਰ ਉਹ ਤਿੰਨ ਤੋਂ ਸ਼ਾਮੀ ਸੱਤ ਅੱਠ ਵਜੇ ਤੱਕ ਖੁੱਲ੍ਹ ਜਾਂਦੀ ਉਹਨਾਂ ਦੀ ਹਾਂਜੀ ਹਾਂਜੀ ਬਿਲਕੁਲ ਜਾ ਜਾ ਸਕਦੇ ਦੋਨੋਂ ਹੀ ਚੱਲਦੇ ਆ ਭਾਅ ਜੀ ਜਿਸ ਤਰਾਂ ਤੁਹਾਨੂੰ ਸਹੀ ਲੱਗਿਆ ਦੋਨੇਂ ਹੀ ਔਨਲਾਈਨ ਜਾਂ ਓਦਾਂ ਹਾਂਜੀ ਹਾਂਜੀ ਬਿਲਕੁਲ ਚੱਲਦਾ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ